ਸਰਦੀਆਂ ਵਿੱਚ ਆਪਣੇ ਪੌਦਿਆਂ ਦੀ ਦੇਖਭਾਲ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਾਂ ਅਸੀਂ ਇਹਨਾਂ ਨੂੰ ਪਾਣੀ ਦਿੰਦੇ ਹਾਂ ਬਟ ਜ਼ਰੂਰਤ ਦੇ ਅਨੁਸਾਰ ਹੀ ਇਹਨਾਂ ਨੂੰ ਪਾਣੀ ਲਗਾਉਦੇ ਹਾਂ ਇਹਨਾਂ ਨੂੰ ਜ਼ਿਆਦਾ ਧੁੱਪ ਵਿੱਚ ਰੱਖਣਾ ਰੱਖਦੇ ਹਾਂ ਤਾਂ ਕਿ ਇਹ ਠੰਡ ਦੇ ਕਾਰਨ ਅਕੜ ਕੇ ਟੁੱਟ ਨਾ ਜਾਣ ਜਾਂ ਕੁਝ ਵੀ ਸਾਨੂੰ ਆਪਣੇ ਪੌਦਿਆਂ ਦੀ ਦੇਖਭਾਲ ਇੱਦਾਂ ਕਰਦੇ ਹਾਂ ਜਿਵੇਂ ਸਾਡੇ ਛੋਟੇ ਬੱਚੇ ਹੋਣ ਸਾਡੇ ਛੋਟੇ ਭੈਣ ਭਰਾ ਹੋਣ ਸਾਡੀ ਹਰ ਤਰੀਕੇ ਨਾਲ ਇਹਨਾਂ ਦੀ ਦੇਖਭਾਲ ਵਿੱਚ ਯੋਗਦਾਨ ਦਿੰਦੇ ਹਾਂ ਇਹਨਾਂ ਨੂੰ ਚੰਗੀ ਖਾਦ ਦਿੰਦੇ ਹਾਂ ਹੈਂ ਬਹੁਤ ਤਰੀਕੇ ਨਾਲ ਅਸੀਂ ਇਹਨੂੰ ਸੰਭ ਸਾਂਭ ਸੰਭਾਲ ਕਰਦੇ ਹਾਂ ਸਰਦੀਆਂ ਦੇ ਵਿੱਚ ਇਹਨੂੰ ਜ਼ਿਆਦਾਤਰ ਧੁੰਦ ਪਾਣੀ ਤੋਂ ਬਚਾ ਕੇ ਰੱਖਣਾ ਚਾ ਚਾਹੀਦਾ ਕਿਉਂਕਿ ਇਹ ਸਰਦੀ ਨਾਲ ਹੀ ਅਕੜ ਕੇ ਟੁੱਟ ਜਾਂਦੇ ਨੇ ਜਾਂ ਮੁਰਝਾ ਜਾਂਦੇ ਨੇ